ਜੀ ਹਾਂ ਅਸੀਂ ਇੱਕ ਬਹੁਤ ਹੀ ਸੁੰਦਰ ਚੜ੍ਹਾਈ ਚੜ੍ਹਨ ਵਾਲਾ ਸਥਾਨ ਵੈਸ਼ਨੂੰ ਦੇਵੀ ਦੀ ਯਾਤਰਾ ਦੇ ਲਈ ਗਏ ਸੀ ਉੱਥੇ ਅਸੀਂ ਆਪਣੀ ਯਾਤਰਾ ਰਾਤ ਦੇ ਸਮੇਂ ਦੇ ਵਿੱਚ ਸ਼ੁਰੂ ਕੀਤੀ ਅਤੇ ਪੂਰੀ ਰਾਤ ਸਫ਼ਰ ਕਰਨ ਤੋਂ ਬਾਅਦ ਅਸੀਂ ਕਟਰਾ ਜੰਮੂ ਜੰਮੂ ਵਿਖੇ ਕਰੀਬ ਸਵੇਰੇ ਤਿੰਨ ਕੁ ਵਜੇ ਪਹੁੰਚ ਗਏ ਅਤੇ ਉੱਥੇ ਜਾ ਕੇ ਅਸੀਂ ਆਪਣਾ ਕਮਰਾ ਬੁੱਕ ਕਰਵਾ ਕੇ ਥੋੜ੍ਹੀ ਦੇਰ ਅਰਾਮ ਅਰਾਮ ਕੀਤਾ ਅਤੇ ਲਗਭਗ ਨੌ ਕੁ ਵਜੇ ਤੱਕ ਅਸੀਂ ਤਿਆਰ ਹੋ ਕੇ ਬ੍ਰੇਕ ਆਪਣਾ ਬ੍ਰੇਕਫਾਸਟ ਵਗੈਰਾ ਕਰਨ ਤੋਂ ਬਾਅਦ ਅਸੀਂ ਆਪਣੀ ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਚੜ੍ਹਾਈ ਚ ਚੜ੍ਹਦਿਆਂ ਚੜ੍ਹਦਿਆਂ ਬਹੁਤ ਸਾਰੀਆਂ ਕਠਿਨਾਈਆਂ ਦਾ ਵੀ ਸਾਹਮਣਾ ਕੀਤਾ ਅਤੇ ਬਹੁਤ ਸਾਰੇ ਸੁੰਦਰ ਪਹਾੜ ਵੀ ਸਾਨੂੰ ਵੇ ਦੇਖਣ ਦੇ ਲਈ ਮਿਲੇ ਰਸਤੇ ਦੇ ਵਿੱਚ ਲੋਕ ਘੋੜਿਆਂ 'ਤੇ ਚੜ੍ਹ ਰਹੇ ਸੀ ਅਤੇ ਕਿਸ ਕਈ ਲੋਕ ਪੈਦਲ ਯਾਤਰਾ ਕ ਕਰ ਰਹੇ ਸੀ ਅਤੇ ਕਈਆਂ ਤੋਂ ਚੜ੍ਹਿਆ ਕਈ ਬਹੁਤ ਹੀ ਸ਼ਰਧਾ ਦੇ ਨਾਲ਼ ਆਪਣਾ ਹੌਲੀ ਹੌਲੀ ਜਿਹੜੀ ਚੜ੍ਹਾਈ ਸੀ ਉਹ ਪੂਰੀ ਕਰ ਰਹੇ ਸੀ ਅਤੇ ਉੱਥੇ ਚੜ੍ਹਾਈ ਚੜ੍ਹਦਿਆਂ ਚੜ੍ਹਦਿਆਂ ਰਸਤੇ ਦੇ ਵਿੱਚ ਬਹੁਤ ਸਾਰੀਆਂ ਸਮਾਨ ਦੀਆਂ ਦੁਕਾਨਾਂ ਆਈਆਂ ਜੋ ਅਸੀਂ ਦੇਖਿਆ ਕਿ ਮਾਤਾ ਰਾਣੀ ਦੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਉੱਥੋਂ ਦੀ ਉੱਥੋਂ ਦੇ ਜਿਹੜੇ ਸਭ ਤੋਂ ਮਸ਼ਹੂਰ ਡ੍ਰਾਈ ਫਰੂਟਸ ਸੁੱਕੇ ਮੇਵੇ ਅਤੇ ਅਖਰੋਟ ਵਗੈਰਾ ਦੇਖਣ ਨੂੰ ਮਿਲੇ ਕਿ ਉੱਥੇ ਕੁਛ ਜਿਹੜਾ ਸੀ ਰੇਟ ਦਾ ਫ਼ਰਕ ਸੀ ਆਪਣੇ ਪੰਜਾਬ ਦੇ ਪੰਜਾਬ ਦੇ ਨਾਲੋਂ ਅਤੇ ਸਭ ਤੋਂ ਜ਼ਿਆਦਾ ਉੱਥੇ ਇੱਕ ਗੱਲ ਮੈਨੂੰ ਇਹ ਠੀਕ ਨਹੀਂ ਲੱਗੀ ਜਦੋਂ ਅਸੀਂ ਆਪਣੀ ਪੂਰੀ ਚੜ੍ਹਾਈ ਚੜ੍ਹ ਕੇ ਉੱਥੇ ਪਹੁੰਚਦੇ ਹਾਂ ਮਾਤਾ ਰਾਣੀ ਦੇ ਦਰਸ਼ਨ ਕਰਨ ਦੇ ਲਈ ਤਾਂ ਟਾਈਮ ਬਿਲਕੁਲ ਨਾ ਦੇ ਬਰਾਬਰ ਦਰਸ਼ਨ ਕਰਨ ਲਈ ਦਿੱਤਾ ਜਾਂਦਾ ਹੈ